ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਧੀਆ ਜੀ ਵਧੀਆ ਲੋਂਗੀਆ ਸਾਹਿਬ ਬੋਲ ਰਹੇ ਤੁਸੀਂ ਹਾਂਜੀ ਕੀ ਕਰੀਏ ਜੀ ਸਰਕਾਰ ਦੇ ਹਾਲਾਤ ਹੀ ਇਹੋ ਜਿਹੇ ਆ ਕੈਨੇਡਾ ਗਿਆ ਹੋਇਆ ਜੀ

ਬਾਹਲਾ ਪੈਸਾ ਲੱਗ ਗਿਆ ਜੀ ਹੁਣ ਕਿਆ ਕਰ ਸਕਦੇ ਹੈ ਹੁਣ ਆਪਣੇ

ਹਾਂਜੀ ਚਲੋ ਉੱਥੇ ਇਹ ਕਿਉਂਕਿ ਮਿਹਨਤ ਦਾ ਮੁੱਲ ਹੈਗਾ ਇਹ ਕਹਿ ਸਕਦੇ ਤੁਸੀਂ ਜਿੰਨੇ ਹਾਂਜੀ ਅਤੇ ਇੱਥੇ ਤਾਂ ਮੇਰੇ ਪੋਤੇ ਨੇ ਵੀ ਆਈ ਆਈ ਟੀ ਰੋਪੜ ਤੋਂ ਕਰੀ ਸੀ ਜੀ ਹਾਂਜੀ ਬੀਟੈਕ ਕਰੀ ਜੀ ਅਤੇ ਉਹ ਤਾਂ ਚਲੋ ਹਾਂਜੀ ਹਾਂਜੀ ਉਹਦੇ ਵੀ ਚਾਂਸਲੀ ਹੈ ਜੀ ਉਹਦੇ ਵੀ ਧਾਂਦਲੀ ਹੈ ਜੀ ਉਹ ਕੰਮ ਸਿਰੇ ਚੜ੍ਹਦਾ ਹੀ ਨਹੀਂ ਹੈ ਦੋ ਦੋ ਸੌ ਤਿੰਨ ਤਿੰਨ ਸੌ ਵਕੈਂਸੀ ਇਹਦੀ ਲਟਕਦੀ ਰਹਿੰਦੀ ਹੈ ਜੀ ਹਾਂਜੀ ਕਿਆ ਕਰੀਏ ਜੀ ਹੁਣ ਐਕਚੁਅਲ ਤਾਂ ਲੋਂਗੀਆ ਸਰ ਬੱਚੇ ਕੋਲ ਆਪਸ਼ਨ ਨਹੀਂ ਹੈ ਨਾ ਇੱਥੇ ਗਲ ਤਾਂ ਇਹ ਹੈ ਰਸੋਰਸਿਜ਼ ਨਹੀਂ ਹੈ ਜੋਬ ਇੱਕ ਹੈ ਜੋ ਹਾਂਜੀ ਜੋਬ ਇੱਕ ਹੈ ਪਾਰਟੀਸਪੇਸ਼ਨ ਹਜ਼ਾਰ ਹੈ ਤਾਂ ਫਿਰ ਦੇਖੋ ਕਿੰਨਾ ਕੰਪਟੀਸ਼ਨ ਹੈ ਇਕ ਬੰਦੇ ਪਿੱਛੇ ਮੈਂ ਵੀ ਹਾਂਜੀ ਮੈਂ ਵੀ ਤਾਂ ਹੀ ਭੇਜਿਆ ਹਾਂਜੀ ਇਹ ਤਾਂ ਹੈ ਚਲੋ ਤਿੰਨ ਚਾਰ ਸਾਲ ਸਟਗਲ ਕਰਲਊਂਗੇ ਉੱਥੇ ਲਾਈਫ ਸੈੱਟ ਹੋ ਜਾਊਗੀ ਪੀ ਆਰ ਪੁ ਆਰ ਮਿਲ ਜਾਊਂਗੀ ਨਾ ਇੱਕ ਵਾਰ ਉੱਥੇ ਜਾ ਕੇ ਅਤੇ ਫਿਰ ਇੱਕ ਟੈਨਸ਼ਨ ਨਹੀਂ ਹੈ ਜ਼ਿੰਦਗੀ 'ਚ ਹਾਂਜੀ ਮੇਰੇ ਕੋਲ ਵੀ ਥੋੜ੍ਹਾ ਜਿਹਾ ਫੰਡ ਪਿਆ ਹੋਇਆ ਸੀ ਅਤੇ ਰਿਟਾਇਰ ਹੋ ਗਿਆ ਸੀ ਮੈਂ ਉੱਥੇ ਲਾ ਲਿਆ ਸਾਰਾ ਫੰਡ ਫਿਰ ਨਾ ਹਾਂਜੀ ਅੱਛਾ ਕਰਦੇ ਕਿਆ ਉੱਥੇ ਅੱਛਾ ਜੀ ਅੱਛਾ ਉਹੀ ਗੱਲ ਆ ਜੀ ਉੱਥੇ ਤਾਂ ਫਿਰ ਬਾਹਲਾ ਹੀ ਮਾੜਾ ਹਾਲ ਆ ਮਤਲਬ ਪਰਸਨਲ ਲਾਇਫ ਦਾ

ਹਾਂਜੀ ਇੱਥੇ ਇੱਥੇ ਇੱਥੇ ਵਰਗੀ ਰੀਸ ਤਾਂ ਹੈ ਨਹੀਂ ਫਿਰ ਹੁਣ ਚੱਕਰ ਉਹੀ ਆ ਨਾ ਜੀ ਕਰੀਅਰ ਵੀ ਦੇਖਣਾ ਪੈਸਾ ਵੀ ਦੇਖਣਾ ਤਾਂ ਫਿਰ ਬਾਹਰ ਜਾਣਾ ਹੀ ਪਊਗਾ ਜੀ ਹਾਂਜੀ ਇਹ ਤਾਂ ਹੈ ਜੀ ਚਲੋ ਕੋਈ ਚੱਕਰ ਨਹੀਂ ਜੀ ਦੋ ਕੁ ਸਾਲ ਸਟਗਲ ਦੋ ਚਾਰ ਸਾਲ ਸਟਗਲ ਉਸ ਤੋਂ ਬਾਅਦ ਕੰਮ ਲੋਟ ਆ ਜਾਊਗਾ ਸਾਰਾ ਜੋ ਨੌਕਰੀਆਂ ਤਾਂ ਜੀ ਨੌਕਰੀਆਂ ਤਾਂ ਕਾਫੀ ਹੈ ਜੀ ਪਰ ਦਿੰਦੇ ਨਹੀਂ ਸਰਕਾਰ ਨੀਤ ਨਹੀਂ ਦੇਣ ਦੀ ਗੱਲ ਇਹ ਹੈ ਜੀ ਹਾਂਜੀ ਚਲੋ ਹੁਣ ਆਇਓ ਕਦੇ ਘਰ ਆਇਓ ਬੈਠਾਂਗੇ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਠੀਕ ਹੈ ਓਕੇ ਜੀ